ਇਕ ਗਾਇਕ ਜਾਂ ਗਾਇਕੀ ਵਿੱਚ ਸੁਧਾਰ ਕਰਨ ਦੇ ਚਾਹਵਾਨ ਵਿਅਕਤੀ ਲਈ ਮੇਰੀ ਇਹ ਸਲਾਹ ਹੈ ਕਿ ਉਹ ਆਵਾਜ਼ ਦੀ ਤਕਨੀਕਾਂ 'ਤੇ ਧਿਆਨ ਦੇਵੇ ਜਿਵੇਂ ਕਿ ਸਾਹ ਲੈਣਾ ਡਾਇਆਰਾਮੈਟਿਕ ਸਾਹ ਲੈਣਾ ਸਿੱਖੋ ਇਹ ਚੰਗੀ ਗਾਇਕੀ ਦੀ ਨੀਂਹ ਹੈ ਮੋਢਿਆਂ ਨੂੰ ਢਿੱਲਾ ਰੱਖ ਕੇ ਸਿੱਧੇ ਖੜੇ ਹੋਵੋ ਜਾਂ ਬੈਠੋ ਇੱਕ ਚੰਗਾ ਆਸਣ ਤੁਹਾਡੀ ਛਾਤੀ ਨੂੰ ਬਿਹਤਰ ਹਵਾ ਦੇ ਪ੍ਰਭਾਵ ਲਈ ਖੋਲ੍ਹਦਾ ਹੈ ਆਵਾਜ਼ ਦੀਆਂ ਕਸਰਤਾਂ ਇਹਨਾਂ ਨੂੰ ਕਦੇ ਨਾ ਛੱਡੋ ਰੇਂਜ ਆਪਣੀ ਵੋਕਲ ਰੇਂਜ ਨੂੰ ਸਮਝੋ ਅਤੇ ਇਸ ਨੂੰ ਸੁਰੱਖਿਅਤ ਢੰਗ ਨਾਲ ਵਧਾਉਣ 'ਤੇ ਕੰਮ ਕਰੋ ਇੱਕ ਸਾਫ਼ ਗੂੰਜਦੀ ਟੂਨ ਦਾ ਟੀਚਾ ਰੱਖੋ ਵੱਖ ਵੱਖ ਸਵਰਾਂ ਅਤੇ ਮੂੰਹ ਦੇ ਆਕਾਰਾਂ ਨਾਲ ਪ੍ਰਯੋਗ ਕਰੋ ਪਿੱਚ ਨੂੰ ਸਹੀ ਢੰਗ ਨਾਲ ਮਿਲਾਉਣ ਦੀ ਅਭਿਆਸ ਕਰੋ ਮਦਦ ਲਈ ਇੱਕ ਪਿਆਨੋ ਜਾਂ ਟਿਊਨਰ ਦੀ ਵਰਤੋਂ ਕਰੋ ਸਕੇਲ ਅਤੇ ਕੋਡ ਇੰਪਰੋਵਾਈਜੇਸ਼ਨ ਲਈ ਸਕੇਲ ਅਤੇ ਕੋਡਾ ਨੂੰ ਸਮਝਾਉਣ ਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕੰਨਾਂ ਦੀ ਸਿਖਲਾਈ ਅੰਤਰਾਲਾ ਕੋਡਾਂ ਅਤੇ ਧੁੰਨਾਂ ਨੂੰ ਕੰਨ ਦੁਆਰਾ ਪਛਾਣਨ ਤੇ ਕੰਮ ਕਰੋ ਇਹ ਤੁਹਾਡੀ ਇੰਪਰੋਵਾਈਜੇਸ਼ਨ ਦੇ ਹੁਨਰ ਨੂੰ ਬਹੁਤ ਸੁਧਾਰ ਕਰੇਗਾ ਅਤੇ ਲਗਾਤਾਰ ਅਭਿਆਸ ਛੋਟੇ ਨਿਯਮਤ ਸੈਸ਼ਨ ਵੀ ਘੱਟ ਅਕਸਰ ਲੰਬੇ ਸੈਸ਼ਨਾਂ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ ਇਹਨਾਂ ਨਾਲ ਇੱਕ ਬੰਦਾ ਆਪਣੇ ਸੰਗੀਤ ਵਿੱਚ ਬਹੁਤ ਸੁਧਾਰ ਲਿਆ ਸਕਦਾ ਹੈ